ਮੇਰਾ ਸਾਥੀ ਟੀਕਾ ਲਵਾਉਣ ਤੋਂ ਝਿਜਕ ਰਿਹਾ ਹੈ ਅਤੇ ਕੋਵਿਡ ਨਾਲ ਟੀਕਿਆਂ ਦੀ ਸੁਰੱਖਿਆ ਅਤੇ ਪ੍ਰਭਾਵ ਬਾਰੇ ਮੈਂ ਹੋਰ ਜਾਣਨਾ ਚਾਹੁੰਦੀ ਹਾਂ ਮੈਂ ਵੈਬਸਾਈਟ ਸਿਹਤ ਵੈਬਸਾਈਟਾਂ ਵਿਗਿਆਨਿਕ ਲੇਖਾਂ ਅਤੇ ਮਾਹਿਰਾਂ ਤੋਂ ਇਸ ਦੇ ਸਰੋਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੀ ਮੈਂ ਉਹਨਾਂ ਤੋਂ ਟੀਕਾਕਰਨ ਦੇ ਲਾਭ ਬਾਰੇ ਪੁੱਛਾਂਗੀ ਅਤੇ ਮੈਂ ਆਪਣੇ ਇਹ ਦੋਸਤ ਨੂੰ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਕਿ ਉਹ ਟੀਕਾਕਰਨ ਕਰਾਉਣ ਵਿੱਚ ਝਿਜਕ ਮਹਿਸੂਸ ਨਾ ਕਰੇ ਕਿਉਂਕੀ ਟੀਕਾਕਰਨ ਕਰਾਉਣ ਦੇ ਕਾਫ਼ੀ ਫਾਇਦੇ ਹਨ ਜਿਸ ਨਾਲ ਸਾਨੂੰ ਆਪਣੇ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਤਾਂ ਸਾਡੀ ਰੋ ਪ੍ਰਤੀਰੋਧ ਸ਼ੱਮਤਾ ਵੀ ਵਧੇਗੀ